ਸਤਿ ਸ਼੍ਰੀ ਅਕਾਲ ਭਾਅ ਜੀ ਗੋਪਾਲ ਢਾਬੇ ਤੋ ਬੋਲ ਰਹੇ ਓ ਜੀ ਅਸੀਂ ਮੋਹਾਲੀ ਛੇ ਫੇਜ਼ ਤੋਂ ਗੱਲ ਕਰ ਰਹੇ ਆ ਜੀ ਗੁਰਦੁਆਰੇ ਦੇ ਨੀਅਰ ਹੀ ਸਾਡਾ ਘਰ ਹੈ ਅਸੀਂ ਪੰਜ ਬੰਦਿਆਂ ਦਾ ਔਡਰ ਕਰਨਾ ਸੀ ਜੀ ਸਾਨੂੰ ਦਾਲ ਰਾਈਸ ਪਨੀਰ ਟਿੱਕਾ ਕਰਡ ਸੈਲਿਡ ਤੰਦੂਰੀ ਰੋਟੀ ਲੱਛਾ ਪਰੌਂਠਾ ਇਹ ਤੁਸੀਂ ਸਾਨੂੰ ਗੁਰੂ ਘਰ ਦੇ ਨੇੜੇ ਹੀ ਸਾਡਾ ਘਰ ਹੈ ਤੁਸੀਂ ਉੱਥੇ ਹੀ ਆ ਕੇ ਸਾਨੂੰ ਕੋਲ ਕਰ ਦਿਓ ਸੇਮ ਨੰਬਰ 'ਤੇ ਥੈਂਕ ਯੂ